ਹਾਂਜੀ ਮੈਂ ਆਪਣੀ ਮੂਲ ਭਾਸ਼ਾ ਨਾਲੋਂ ਵੱਖਰੀ ਭਾਸ਼ਾ ਅੰਗਰੇਜ਼ੀ ਵਿੱਚ ਕਿਤਾਬ ਪੜ੍ਹੀ ਹੋਈ ਹੈ ਦਾ ਫਲਾਇੰਗ ਸਿੱਖ ਮਿਲਖਾ ਸਿੰਘ ਇਸ ਵਿੱਚ ਉਹਨਾਂ ਦੀ ਜੀਵਨੀ ਬਾਰੇ ਦੱਸਿਆ ਕਿ ਕਿਵੇਂ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਉਹ ਆਪਣੇ ਪਰਿਵਾਰ ਤੋਂ ਵਿਛੜ ਗਏ ਸਨ ਅਤੇ ਉਹਨਾਂ ਦੀ ਭੈਣ ਨੇ ਉਹਨਾਂ ਨੂੰ ਸੰਭਾਲਿਆ ਸੀ ਅਤੇ ਉਹਨਾਂ ਨੇ ਭਾਰਤ ਆਰਮੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਸੀ ਅਤੇ ਉੱਥੋਂ ਦੀ ਹੀ ਉਹਨਾਂ ਨੇ ਦੌੜਨਾ ਸ਼ੁਰੂ ਕੀਤਾ ਸੀ ਉਹਨਾਂ ਨੂੰ ਫਲਾਇੰਗ ਸਿੱਖ ਦਾ ਟਾਈਟਲ ਪਾਕਿਸਤਾਨ ਅਤੇ ਭਾਰਤ ਦੀ ਓਲੰਪਿਕਸ ਦੌਰਾਨ ਮਿਲਿਆ ਸੀ ਕਿਉਂਕਿ ਉਹਨਾਂ ਨੇ ਪਾਕਿਸਤਾਨ ਦੇ ਸਭ ਤੋਂ ਤੇਜ਼ ਖਿਲਾੜੀ ਅਬਦੁੱਲ ਖਾਲਿਦ ਨੂੰ ਹਰਾ ਦਿੱਤਾ ਸੀ ਉਹਨਾਂ ਨੇ ਚਾਰ ਸੌ ਮੀਟਰ ਰੇਸ ਸਿਰਫ ਪੰਤਾਲੀ ਪੁਆਇੰਟ ਅਠਾਈ ਸੈਕਿੰਡ ਵਿੱਚ ਹੀ ਖਤਮ ਕਰ ਦਿੱਤੀ ਸੀ ਇਸ ਕਰਕੇ ਮਿਲਖਾ ਸਿੰਘ ਨੂੰ ਪਦਮ ਸ਼੍ਰੀ ਅਵਾਰਡ ਅਵਾਰਡ ਨਾਲ ਸਨਮਾਨਿਤ ਕੀਤਾ ਕੀਤਾ ਸੀ ਅਤੇ ਉਹਨਾਂ ਨੇ ਭਾਰਤ ਲਈ ਚਾਰ ਗੋਲਡ ਮੈਡਲ ਵੀ ਜਿੱਤੇ ਸਨ ਉੱਨੀ ਸੌ ਛਪੰਜਾ ਤੋਂ ਲੈ ਕੇ ਉੱਨੀ ਸੌ ਚੋਂਹਠ ਤੱਕ ਤੱਕ ਮਿਲਖਾ ਸਿੰਘ ਜੀ ਦਾ ਜੀਵਨ ਵੈਸੇ ਬਚਪਨ ਵਿੱਚ ਵੈਸੇ ਤਾਂ ਬਹੁਤ ਗਰੀਬੀ ਵਿੱਚ ਬੀਤਿਆ ਪਰ ਉਹਨਾਂ ਨੇ ਆਪਣੀ ਮਿਹਨਤ ਨਾਲ ਆਪਣਾ ਪਰਿਵਾਰ ਸਥਾਪਿਤ ਕੀਤਾ